ਇਕ ਖੂਹ ਤੋਂ ਪਾਣੀ ਕੱਢਣ ਲਈ ਲੋਕ ਰੱਸੀ ਔਰ ਬਾਲਟੀ ਦੇ ਨਾਲ ਪਾਣੀ ਉੱਪਰ ਖਿੱਚ ਕੇ ਪਾਣੀ ਕੱਢਦੇ ਹਨ ਇਹ ਚੀਜ਼ ਪੁਰਾਣੇ ਜ਼ਮਾਨੇ ਵਿੱਚ ਕਾਫੀ ਵਰਤੀ ਜਾਂਦੀ ਸੀ ਪਰ ਅੱਜ ਕੱਲ੍ਹ ਲੋਕ ਇਸ ਨੂੰ ਛੱਡ ਕੇ ਮੋਟਰ ਰਾਹੀਂ ਪਾਣੀ ਕੱਢਦੇ ਹਨ ਜੋ ਕਿ ਬਹੁਤ ਅਸਾਨ ਤਰੀਕਾ ਹੈ ਜਿਸ ਵਿੱਚ ਲੋਕਾਂ ਦਾ ਜ਼ਿਆਦਾ ਜ਼ੋਰ ਨਹੀਂ ਲੱਗਦਾ ਮੋਟਰ ਨੂੰ ਪਾ ਖੂਹ ਦੇ ਨਾਲ ਲੰਬੀਆਂ ਪਾਈਪਾਂ ਨਾਲ ਕਨੈਕਟ ਕੀਤਾ ਜਾਂਦਾ ਹੈ ਖੂਹ ਦੇ ਨੇੜੇ ਬਿਜਲੀ ਦਾ ਕਨੈਕਸ਼ਨ ਦੇ ਨਾਲ ਮੋਟਰ ਨੂੰ ਚਲਾਇਆ ਜਾਂਦਾ ਹੈ ਜਿਸ ਨਾਲ ਪਾਣੀ ਅਸਾਨੀ ਅਸਾਨ ਤਰੀਕੇ ਨਾਲ ਨਿਕਾਲਿਆ ਜਾਂਦਾ ਹੈ ਅਤੇ ਲੋਕਾਂ ਨੂੰ ਇਸ ਵਿੱਚ ਜ਼ਿਆਦਾ ਜ਼ੋਰ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਪਾਣੀ ਅਸਾਨੀ ਨਾਲ ਇੱਕ ਬਟਨ ਦਬਾਏ ਹੀ ਟੂਟੀਆਂ ਵਿੱਚ ਆ ਜਾਂਦਾ ਹੈ